ਮੈਨੂੰ ਬੈਡਮਿੰਟਨ ਖੇਡਣ ਦਾ ਬਹੁਤ ਸ਼ੌਂਕ ਹੈ ਅਤੇ ਇਹ ਸ਼ੌਂਕ ਮੈਨੂੰ ਉਦੋਂ ਪਿਆ ਜਦੋਂ ਛੋਟੇ ਹੁੰਦਿਆਂ ਮੇਰੇ ਭੂਆ ਨੇ ਮੈਨੂੰ ਬੈਡਮਿੰਟਨ ਗਿਫਟ ਕੀਤਾ ਅਤੇ ਉਹ ਮੈਨੂੰ ਬਹੁਤ ਹੀ ਪਸੰਦ ਆਇਆ ਮੈਂ ਇਸ ਨੂੰ ਖੇਡਣਾ ਸ਼ੁਰੂ ਕੀਤਾ ਅਤੇ ਇਹ ਖੇਡ ਮੈਨੂੰ ਬਹੁਤ ਹੀ ਪਸੰਦ ਆਈ ਅਤੇ ਹੁਣ ਇਸ ਖੇਡ ਨੂੰ ਮੈਂ ਅਸੀਂ ਮੇਰੇ ਸਹੇਲੀਆਂ ਰਲ ਕੇ ਖੇਡਦੇ ਹਾਂ ਅਤੇ ਇਸ ਸੰਡੇ ਨੂੰ ਆਪਾਂ ਕੰਪਨੀ ਬਾਗ ਵਿੱਚ ਇਸ ਖੇਡ ਨੂੰ ਦਾ ਮੈਚ ਵੀ ਲਗਾਉਂਦੇ ਹਾਂ ਅਸੀਂ ਕਦੇ ਕਦੇ ਸਿੰਗਲ ਜਾਂ ਡਬਲ ਵੀ ਖੇਡ ਲੈਂਦੇ ਹਾਂ ਮੈਨੂੰ ਇਸ ਖੇਡ ਵਿੱਚ ਬਹੁਤ ਮਜ਼ਾ ਆਉਂਦਾ ਹੈ ਡਬਲ ਵਿੱਚ ਮੇਰੀ ਪੱਕੀ ਸਹੇਲੀ ਮੇਰੇ ਨਾਲ ਹੁੰਦੀ ਹੈ ਅਤੇ ਅਸੀਂ ਦੋਨੋਂ ਮੈਚ ਜਿੱਤ ਜਾਂਦੇ ਹਾਂ ਇਸ ਲਈ ਮੈਨੂੰ ਇਹ ਮੈਚ ਬਹੁਤ ਹੀ ਪਸੰਦ ਆਇਆ